ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਮੈਂ ਪਿੰਡ ਟੱਪਰੀਆਂ ਦਾ ਰਹਿਣ ਵਾਲਾ ਜੀ ਲਾਸਟ ਮੰਥ ਨਾ ਜੀ ਮੈਂ ਇੱਕ ਬੈਂਟਰੀ ਵਾਲੇ ਹੈੱਡਫੋਨ ਲਏ ਤੇ ਜੀ ਜੋ ਕਿ ਜੋ ਉਸਦੇ ਡੱਬੇ ਦੇ ਦੱਸਿਆ ਗਿਆ ਤਾਂ ਉਸ ਨਾਲ਼ ਤਾਂ ਬਿਲਕੁਲ ਹੀ ਉਲਟ ਸਨ ਮੈਂ ਉਹ ਹੈੱਡਫੋਨ ਜੀ ਦਸ ਹਜ਼ਾਰ ਦੇ ਲਏ ਅਤੇ ਜੀ ਆਈ ਫੋਨ ਵਾਲਿਆਂ ਦੇ ਓਰਿਜਨਲ ਹੈੱਡਫੋਨ ਤੇ ਜੀ ਅਤੇ ਉਹਦੇ 'ਚ ਦੱਸਿਆ ਗਿਆ ਤਾਂ ਵੀ ਇਹ ਜਿਹੜੇ ਹੈੱਡਫੋਨ ਹੈ ਵੀ ਇਹ ਪੰਜ ਤੋਂ ਛੇ ਘੰਟੇ ਬੈਂਟਰੀ ਬੈੱਕਅੱਪ ਹੈ ਜੀ ਇਨ੍ਹਾਂ ਦਾ ਜਦਕਿ ਮੈਂ ਇਹਨਾਂ ਨੂੰ ਯੂਜ਼ ਕਰਨ ਲੱਗਿਆ ਤਾਂ ਮੈਂ ਦੇਖਿਆ ਕਿ ਇੱਕ ਤੋਂ ਦੋ ਘੰਟੇ ਦੇ ਵਿੱਚ ਹੀ ਇਹ ਖ਼ਤਮ ਹੋ ਜਾਨੇ ਐਂ ਜਦੋਂ ਜੀ ਮੈਂ ਜੌਬ 'ਤੇ ਜਾਣ ਲੱਗ ਗਿਆ ਅਤੇ ਇੱਕ ਹੈੱਡਫੋਨ ਦਾ ਜੋ ਲਾਉਣ ਵਾਲਾ ਹੁੰਦਾ ਉਹ ਕੰਨ ਚੋਂ ਹੀ ਟੁੱਟ ਗਿਆ ਜਿਸ ਨਾਲ਼ ਕਿ ਬਹੁਤ ਹੀ ਮੇਰਾ ਨੁਕਸਾਨ ਹੋਇਆ ਅਤੇ ਮੈਂ ਇਹੀ ਕਹਿਣਾ ਚਾਹੁੰਨਾ ਜੀ ਐਂਡ 'ਚ ਵੀ ਹੈੱਡਫੋਨ ਜਮ੍ਹਾਂ ਹੀ ਵੇਸਟਏਜ਼ ਔਫ ਮਨੀ ਹੈ ਜੀ ਲੈਣੇ ਨਹੀਂ ਚਾਹੀਦੇ ਬਹੁਤ ਬਹੁਤ ਧੰਨਵਾਦ ਜੀ